ਮੇਰੇ ਮੋਹਾਲੀ ਜ਼ਿਲ੍ਹੇ ਵਿੱਚ ਏਸ ਟਾਇਮ ਤਾਂ ਝਾੜੂ ਆਲਿਆਂ ਦੀ ਸਰਕਾਰ ਐ ਆਪ ਸਰਕਾਰ ਆ ਜਿਹਦੇ ਕਿ ਐਮ ਐੱਲ ਐ ਬੀਬੀ ਅਨਮੋਲ ਗਗਨ ਮਾਨ ਜਣੀ ਕੇ ਐਂਤਕੀ ਮਾੜੇ ਮੋਟੇ ਉਮੀਂਦ ਹੈਂਗੀ ਆ ਵੀ ਕੰਮ ਹੋਊਗੇ ਹਾਲ ਦੀ ਕੜੀ ਕੋਈ ਵੀ ਨੀ ਹੋਇਆ ਦੇਖਦੇ ਆ ਵੀ ਹੁਣ ਕਆ ਹੁੰਦਾ ਏ ਬਾਕੀ ਉੱਦਾ ਐੱਸ ਐੱਸ ਪੀ ਹੋਗੇ ਡੀ ਸੀ ਹੋਗੇ ਏਹਤਾ ਸਾਰੇ ਉਹਨਾਂ ਦੇ ਥੱਲੇ ਲਗਕੇ ਚੱਲਦੇ ਆ ਬਾਕੀ ਸਾਡੇ ਇਲਾਕੇ ਦੇ ਵਿੱਚ ਨਸ਼ੇ ਦਾ ਕੰਮ ਬਹੁਤ ਤਗੜਾ ਏ ਕਾਰੋਬਾਰ ਐ ਇਕ ਤਰ੍ਹਾਂ ਇਲਾਕੇ ਇਲਾਕੇ ਬ ਸਾਡੇ ਇੱਕ ਤਰ੍ਹਾਂ ਦਾ ਜੇ ਸਾਡੇ ਇਲਾਕੇ ਚੋ ਏਸ ਟੈਮ ਦੋ ਬੰਦੇ ਕਾਮਯਾਬ ਐ ਇੱਕ ਜਿਹੜੇ ਪ੍ਰੋਪਰਟੀ ਡੀਲਰ ਐ ਦੂਏ ਜਿਹੜੇ ਚਿੱਟੇ ਦੇ ਡੀਲਰ ਐ ਇਹਨਾਂ ਦੀ ਬੱਲੇ ਬੱਲੇ ਐ ਇਹਨਾਂ ਦੇ ਬਿਨ੍ਹਾਂ ਬਾਕੀ ਸਭ ਦਾ ਵੇੜਾ ਬੈਠਿਆ ਵਾ ਏ ਸਾਰੇ ਡੁੱਬੇ ਵੇ ਆ ਬਾਕੀ ਪੁਲਸ ਪਾਲਸ ਦੀ ਗੱਲ ਕਰੀਏ ਉਹ ਤਾਂ ਅਹੀਜੀ ਓ ਆ ਪੁਲਸ ਦੇ ਤਾ ਕਹਿਣੇ ਹੀ ਕਆ ਏ ਉਹ ਚੱਲਦੀਓ ਪੈਸੇ ਨਾਲ਼ ਐ ਬਸ ਜਿਹਨੇ ਪੈਸੇ ਦੇ ਤੇ ਬਾ ਉਹਦੀਂ ਪੁਲਿਸ ਹੋ ਜਾਂਦੀ ਐ ਅਜਿਹਾ ਹਾਲ ਐ ਬਾਕੀ ਸੜਕਾ ਸੂੜਕਾਂ ਸਾਡੇ ਪਿੰਡਾਂ ਦੀਆਂ ਟੁੱਟੀਆਂ ਵੀਆਂ ਆ ਹਲੇ ਮਾੜੀ ਮੋਟੀ ਬਾਦਲ ਸਰਕਾਰ ਦੇ ਟੈਂਮ ਚੋ ਐ ਤਾ ਵੀ ਚੱਲ ਉਹਨਾਂ ਨੇ ਏਧਰ ਨੂੰ ਹੋਟਲ ਜਾ ਬਣਾਇਆ ਆਪਣਾ ਉਦੇ ਕਰਕੇ ਸਾਡੇ ਜਿਲ੍ਹੇ ਦੇ ਵਿੱਚ ਜਣੀ ਕੇ ਜ਼ਮੀਨ ਖਾਸੀ ਮਹਿੰਗੀ ਹੋ ਗਈ ਬਾਕੀ ਸਾਰੇ ਇਲਾਕਿਆਂ ਨਾਲੋਂ ਸਾਡੇ ਜਣੀ ਕੇ ਜ਼ਿਲ੍ਹੇ ਚੋ ਜ਼ਮੀਨ ਸੋਹਣੀ ਮਹਿੰਗੀ ਐ ਤੇ ਬਾਕੀ ਉਹਤੇ ਇਲਾਵਾ ਹੋਰ ਕੋਈ ਤਰੱਕੀ ਦਾ ਕੰਮ ਕੋਈ ਵੀ ਨੀ ਹੈ ਬਾਕੀ ਹੋਰ ਜੇ ਆਗੂਆਂ ਦੀ ਗੱਲ ਕਰੀਏ ਤਾਂ ਜਗਮੋਹਨ ਸਿੰਘ ਕੰਗ ਵੀ ਹੋੋਇਆ ਏ ਸਾਡੇ ਇਲਾਕੇ ਦੇ ਵਿੱਚ ਬਹੁਤ ਉੱਘੀ ਸਖ਼ਸੀਅਤ ਹੋਈ ਐ ਉਹਤੇ ਇਲਾਵਾ ਇੱਕ ਬਡਾਲੀ ਹੁੰਦਾ ਤਾ ਇਹ ਪਹਿਲੇ ਟੈਂਮ ਦੇ ਤੇ ਹੁਣ ਤਾਂ ਇਹਨਾਂ ਦਾ ਅਤਾ ਪਤਾ ਵੀ ਨੀ ਰਿਹਾ ਕਿੱਥੇ ਗਏ ਬਾਕੀ ਰਣਜੀਤ ਗਿੱਲ ਹੈਂਗਾ ਐ ਉਹ ਪੈਸੇ ਆਲੀ ਅਸਾਮੀ ਐ ਉਹਨਾਂ ਵੋਟਾਂ ਚੋ ਦਾਰੂ ਦੋਰੂ ਪਲਾਕੇ ਜ਼ੋਰ ਬਹੁਤ ਲਾਇਆ ਪਰ ਵਿਚਾਰੇ ਦਾ ਬਣਿਆ ਨੀ ਕੰਮ ਚਲੋ ਇਹ ਤਾਂ ਹੁਣ ਰੱਬ ਦੇ ਹੱਥ ਐ ਜਿਹਦਾ ਜੋ ਬਣਨਾ